ਹੈਲੋ ਹਾਂਜੀ ਮਲੋਟ ਵਿੱਚ ਆਰਨੇਟ ਆ ਰਿਹਾ ਹੈ ਉਸ ਲਈ ਮੈਨੂੰ ਸੱਦਾ ਦਿੱਤਾ ਗਿਆ ਹੈ ਤੇ ਮੈਂ ਇਹ ਪੁੱਛਣਾ ਚਾਹੁੰਦੀ ਆ ਕੀ ਉਹ ਸਮਾਗਮ ਕਿੰਨੇ ਵਜੇ ਸ਼ੁਰੂ ਹੋਏਗਾ ਅਤੇ ਕਿੱਥੇ ਹੋਣਾ ਹੈ ਅਤੇ ਕਿੰਨੇ ਵਜੇ ਸ਼ੁਰੂ ਹੋਏਗਾ ਕਿੰਨੇ ਵਜੇ ਖਤਮ ਹੋਏਗਾ ਮੈਂ ਸੁਣਿਆ ਹੈ ਕਿ ਆਰਨੇਟ ਇੱਕ ਬਹੁਤ ਵਧੀਆ ਗਾਇਕ ਹੈ ਅਤੇ ਮੈਂ ਉਸਦੇ ਗਾਣਿਆਂ ਨੂੰ ਬਹੁਤ ਦਿਲਚਸਪੀ ਨਾਲ ਸੁਣਦੀ ਹਾਂ ਉਹ ਇੱਕ ਬਹੁਤ ਵਧੀਆ ਗਾਇਕ ਹੈ ਜੋ ਕੀ ਮੈਂ ਆਪਣੇ ਪਰਿਵਾਰ ਦੇ ਸਮੇਤ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹਨੀ ਆ ਉੱਥੇ ਮੈਂ ਸੁਣਿਆ ਹੈ ਕਿ ਉੱਥੇ ਕਿਸਾਨ ਮੇਲਾ ਵੀ ਲੱਗਿਆ ਹੋਇਆ ਹੈ ਅਤੇ ਇਸ ਕਿਸਾਨ ਮੇਲੇ ਵਿੱਚ ਬਹੁਤ ਸਾਰੇ ਕੰਪਨੀਆਂ ਨੇ ਹਿੱਸਾ ਲਿਆ ਹੈ ਅਤੇ ਇਸ ਕਿਸਾਨ ਮੇਲੇ ਵਿੱਚ ਮੈਂ ਮੈਂ ਆਪਣੇ ਬੱਚਿਆਂ ਨਾਲ ਜਾਣਾ ਚਾਹੁੰਦੀ ਹਾਂ ਤਾਂ ਕਿ ਮੇਰੇ ਬੱਚਿਆਂ ਨੂੰ ਵੀ ਸਭ ਕੁਝ ਪਤਾ ਲੱਗ ਸਕੇ ਤੇ ਉਹ ਉਸ ਗਾਇਕ ਨੂੰ ਵੀ ਚੰਗੀ ਤਰ੍ਹਾਂ ਜਾਣ ਸਕਣ ਅਤੇ ਮੈਨੂੰ ਬਹੁਤ ਦਿਲਚਸਪੀ ਹੈ ਉਸ ਦੇ ਗਾਣੇ ਸੁਣਨ ਦੀ ਅਤੇ ਮੈਂ ਬੜੀ ਦਿਲਚਸਪੀ ਨਾਲ ਇਸ ਦੀ ਇਸ ਉਹਨਾਂ ਦੀ ਉਡੀਕ ਕਰ ਰਹੀ ਹਾਂ ਤਾਂ ਜੋ ਜਲਦੀ ਜਲਦੀ ਇਸ ਵਿੱਚ ਸ਼ਾਮਿਲ ਹੋ ਸਕਾਂ ਤਾਂ ਮੈਨੂੰ ਇਹ ਦੱਸੋ ਕਿ ਕਿੰਨੀ ਤਰੀਕ ਨੂੰ ਹੈ ਕਿੰਨੇ ਕਿੰਨਾ ਟਾਈਮ ਹੈ ਅਤੇ ਕਿੰਨੇ ਵਜੇ ਮਤਲਬ ਸ਼ੁਰੂ ਹੋਏਗਾ ਸਮਾਗਮ ਦਿਨ ਦਾ ਹੈ ਕਿ ਰਾਤ ਦਾ ਹੈ ਇਸ ਲਈ ਤਾਂ ਕਿ ਮੈਂ ਉੱਥੇ ਸ਼ਿਰਕਤ ਕਰ ਸਕਾਂ ਠੀਕ ਹੈ